ਮੈਂ ਰਾਕੇਸ਼ ਸੁਜਾਨਪੁਰ ਜ਼ਿਲ੍ਹਾ ਪਠਾਨਕੋਟ ਦੀ ਵਾਸੀ ਸਕੂ ਕਹਿਣਾ ਚਾਹਵਾਂਗੀ ਕਿ ਸਕੂਲ ਤੋਂ ਬਾਅਦ ਸ਼ਾਮ ਦੀ ਜੋ ਟਿਊਸ਼ਨ ਹੈ ਜਾਂ ਪ੍ਰਾਈਵੇਟ ਕਲਾਸਾਂ ਜੋ ਬੱਚੇ ਲੈਂਦੇ ਹਨ ਉਸ ਦੇ ਬਾਰੇ ਮੇਰੀ ਸੋਚ ਹੈ ਕਿ ਬੱਚਿਆਂ ਨੂੰ ਇਸ ਦੇ ਨਾਲ ਮਦਦ ਤਾਂ ਜ਼ਰੂਰ ਮਿਲਦੀ ਹੈ ਪਰ ਮਾਂ ਬਾਪ ਦੇ ਉੱਤੇ ਇਹ ਇੱਕ ਬਰਡਨ ਜ਼ਰੂਰ ਪੈਂਦਾ ਹੈ ਕਿ ਵਾਧੂ ਪੈਸਾ ਉਨ੍ਹਾਂ ਨੂੰ ਦੇਣਾ ਪੈਂਦਾ ਹੈ ਜੇ ਸਾਡੇ ਸਕੂਲਾਂ ਦੇ ਵਿੱਚ ਵਧੀਆ ਢੰਗ ਦੇ ਨਾਲ ਬੱਚਿਆਂ ਨੂੰ ਪੜ੍ਹਾਈ ਕਰਵਾਈ ਜਾਵੇ ਤਾਂ ਸਾਨੂੰ ਇਹ ਸਕੂਲ ਤੋਂ ਬਾਅਦ ਦੀ ਜਿਹੜੀ ਟਿਊਸ਼ਨ ਦੀ ਜ਼ਰੂਰਤ ਹੈ ਜਾਂ ਪ੍ਰਾਈਵੇਟ ਕਲਾਸਾਂ ਦੀ ਜ਼ਰੂਰਤ ਹੈ ਇਹ ਜ਼ਰੂਰਤ ਹੀ ਨਾ ਪਵੇ ਸਾਡੇ ਬੱਚਿਆਂ ਨੂੰ ਇਸਦੇ ਬਾਰੇ ਸੋਚਣ ਦੀ ਲੋੜ ਹੀ ਨਾ ਪਵੇ ਕਿ ਉਨ੍ਹਾਂ ਨੂੰ ਪ੍ਰਾਈਵੇਟ ਕਲਾਸਾਂ ਲੈਣੀਆਂ ਹਨ ਜਾਂ ਸ਼ਾਮ ਨੂੰ ਉਨ੍ਹਾਂ ਨੂੰ ਕੋਈ ਟਿਊਸ਼ਨ ਚਾਹੀਦੀ ਹੈ ਅਗਰ ਉਨ੍ਹਾਂ ਨੂੰ ਇਸ ਟਿਊਸ਼ਨ ਦੀ ਲੋੜ ਪੈਂਦੀ ਵੀ ਹੈ ਤਾਂ ਉਹ ਆਪਣੇ ਅਧਿਆਪਕਾਂ ਦੇ ਕੋਲੋਂ ਸਕੂਲ ਦੇ ਸਮੇਂ ਹੀ ਪੁੱਛ ਸਕਦੇ ਹਨ ਆਪਣੇ ਜੋ ਵੀ ਡਾਊਟ ਨੇ ਉਹ ਕਲੀਅਰ ਕਰ ਸਕਦੇ ਹਨ ਤਾਂ ਜੋ ਮਾਪਿਆਂ ਦੇ ਉੱਤੇ ਓਵਰ ਬਰਡਨ ਨਾ ਪਵੇ ਕਿਉਂਕਿ ਉਹ ਐਨਾ ਸਮਾਜ ਦੇ ਵਿੱਚ ਮਹਿੰਗਾਈ ਵੱਧ ਰਹੀ ਹੈ ਜਿਸ ਦੇ ਨਾਲ ਉਹ ਮਾਪੇ ਜੋ ਹਨ ਬੜੀ ਮੁਸ਼ਕਲ ਦੇ ਨਾਲ ਆਪਣੇ ਬੱਚਿਆਂ ਦੀਆਂ ਫੀਸਾਂ ਹੀ ਦੇ ਪਾਉਂਦੇ ਹਨ ਪਰ ਜੇ ਸੋਚਿਆ ਜਾਵੇ ਕਿ ਬੱਚਿਆਂ ਨੂੰ ਉੱਥੇ ਫੇਰ ਪੜ੍ਹਾਈ ਚੰਗੀ ਨਾ ਹੋਵੇ ਫੇਰ ਉਨ੍ਹਾਂ ਨੂੰ ਪ੍ਰਾਈਵੇਟ ਟਿਊਸ਼ਨ ਦੀ ਲੋੜ ਪਵੇ ਜਾਂ ਫੇਰ ਸਕੂਲਾਂ ਤੋਂ ਬਾਅਦ ਪ੍ਰਾਈਵੇਟ ਕਲਾਸਾਂ ਦੀ ਲੋੜ ਪਵੇ ਤਾਂ ਇਹ ਮੈਂ ਤਾਂ ਚੰਗੀ ਗੱਲ ਨਹੀਂ ਸਮਝਾਂਗੀ ਮੈਨੂੰ ਜਿੱਥੇ ਤੱਕ ਯਕੀਨ ਹੈ ਅਗਰ ਅਧਿਆਪਕ ਬਹੁਤ ਵਧੀਆ ਢੰਗ ਦੇ ਨਾਲ ਸਕੂਲ ਦੇ ਵਿੱਚ ਬੱਚਿਆਂ ਨੂੰ ਸ਼ੋਟ ਮੈਥਡ ਨਾ ਛਡ ਕਰਵਾ ਕੇ ਲੋਂਗ ਮੈਥਡ ਦੇ ਨਾਲ ਔਰ ਸਮਾਟ ਕਲਾਸਿਜ ਦੇ ਨਾਲ ਵਧੀਆ ਢੰਗ ਨਾਲ ਪੜ੍ਹਾਇਆ ਜਾਵੇ ਤਾਂ ਬੱਚਿਆਂ ਨੂੰ ਇਨ੍ਹਾਂ ਪ੍ਰਾਈਵੇਟ ਇੰਸਟੀਚਿਊਟ ਦੇ ਵਿੱਚ ਜੋ ਟਿਊਸ਼ਨਸ ਦੀ ਲੋੜ ਹੈ ਸ਼ਾਮ ਦੀ ਟਿਊਸ਼ਨ ਦੀ ਲੋੜ ਹੈ ਉਹ ਨਹੀਂ ਪੈ ਸਕਦੀ ਧੰਨਵਾਦ